ਤਿੰਨ ਅਗਸਤ ਉੱਨੀ ਸੌ ਸੰਤਾਲੀ ਨੌਂ ਸਪਤੰਬਰ ਉੱਨੀ ਸੌ ਉਨਾਣਵੇਂ ਇੱਕੀ ਜਨਵਰੀ ਉੱਨੀ ਸੌ ਅਠਾਨਵੇਂ ਪੱਚੀ ਦਸੰਬਰ ਦੋ ਹਜ਼ਾਰ ਤੇਰ੍ਹਾਂ ਉੱਨੀ ਅਕਤੂਬਰ ਦੋ ਹਜ਼ਾਰ ਚੌਵੀ